ਮੈਂ ਚਾਰ ਮਹੀਨੇ ਪਹਿਲਾਂ ਇੱਕ ਐੱਚ ਪੀ ਲੈੱਪਟੋਪ ਲਿੱਤਾ ਸੀ ਜੋ ਕਿ ਉਹ ਮੈਨੂੰ ਬਹੁਤ ਵਧੀਆ ਲੱਗਿਆ ਉਹ ਬਹੁਤ ਵਧੀਆ ਚੱਲਦਾ ਹੈ ਉਸਦੀ ਸਪੀਡ ਵੀ ਬਹੁਤ ਵਧੀਆ ਹੈ ਅਤੇ ਥਰਟੀਨ ਜਨਰੇਸ਼ਨ ਦਾ ਹੈ ਉਹ ਉਸਦਾ ਰੈਮ ਵੀ ਬਹੁਤ ਵਧੀਆ ਹੈ ਅਤੇ ਉਸਦੀ ਸਕਰੀਨ ਵੀ ਮਤਲਬ ਬਹੁਤ ਸਲਿੱਮ ਅਤੇ ਬਹੁਤ ਵਧੀਆ ਹੈ ਉਹ ਮਤਲਬ ਵੇਟ ਵਿੱਚ ਵੀ ਚੱਕਣ ਵਿੱਚ ਬਹੁਤ ਵਧੀਆ ਹਲਕਾ ਹੈ ਉਸਦਾ ਵੇਟ ਵੀ ਜ਼ਿਆਦਾ ਨਹੀਂ ਹੈ ਉਹ ਸਿਲਵਰ ਕਲਰ ਦਾ ਹੈ ਅਤੇ ਇਹ ਪ੍ਰੋਡਕਟ ਮੈਨੂੰ ਬਹੁਤ ਵਧੀਆ ਲੱਗਿਆ